ਸਥਾਨਕ ਕਹਾਣੀਆਂ ਜਾਂ ਕਥਾਵਾਂ ਉਹ ਹਨ ਜੋ ਕਿਸੇ ਸਥਾਨ ਦੇ ਅਨੁਸਾਰ ਬਣੀਆਂ ਹੋਵੇ ਲੋਕਾਂ ਦੇ ਵਿੱਚ ਕਾਫੀ ਪ੍ਰਚੱਲਿਤ ਹੋਣ ਰੂਪਨਗਰ ਜ਼ਿਲ੍ਹੇ ਦੇ ਵਿੱਚ ਕਾਫੀ ਇਹੋ ਜਿਹੀਆਂ ਕਥਾਵਾਂ ਜੁੜੀਆਂ ਹੋਈਆਂ ਹਨ ਜਿਵੇਂ ਕਿ ਮੀਂਹ ਨਾ ਹੋਵੇ ਤਾਂ ਬੱਚੇ ਅਤੇ ਬੱਚੇ ਕਾਫੀ ਖੇਡਾਂ ਇਹੋ ਜਿਹੀਆਂ ਖੇਡਦੇ ਹਨ ਜਿਨ੍ਹਾਂ ਨਾਲ ਕਿ ਭਗਵਾਨ ਇੰਦਰ ਦੇਵਤਾ ਖੁਸ਼ ਹੋ ਕੇ ਵਰਖਾ ਬਰਸਾ ਦਿੰਦਾ ਹਨ ਅਤੇ ਛੋਟੀਆਂ ਛੋਟੀਆਂ ਲੜਕੀਆਂ ਵੀ ਗੁੱਡੀਆਂ ਬਣਾ ਕੇ ਖੇਡਦੇ ਹਨ ਸਿਰਫ ਮੀਂਹ ਦੇ ਵਾਸਤੇ ਇਹ ਕਹਾਣੀਆਂ ਸਾਡੇ ਜ਼ਿਲ੍ਹੇ ਦੇ ਇਤਿਹਾਸਕ ਸੱਭਿਆਚਾਰਕ ਪ੍ਰੰਪਰਾਵਾਂ ਬਾਰੇ ਦਰਸਾਉਂਦੀਆਂ ਹਨ ਕਿ ਸਾਡਾ ਪਹਿਲਾਂ ਸੱਭਿਆਚਾਰ ਕਿਹੋ ਜਿਹਾ ਸੀਗਾ ਜ਼ਿਲ੍ਹੇ ਦਾ ਇਤਿਹਾਸ ਦੇ ਵਿੱਚ ਗੁਰਦੁਆਰਾ ਭੱਠਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਰਸਾ ਨਦੀ ਪਾਰ ਕਰਕੇ ਪੁੱਜੇ ਤਾਂ ਇੱਕ ਭੱਠਾ ਇੱਟਾਂ ਦਾ ਤਪ ਰਿਹਾ ਸੀਗਾ ਉਹ 'ਚ ਇੱਟਾਂ ਪੱਕ ਰਹੀਆਂ ਸਨ ਤਾਂ ਘੋੜਾ ਉਸ ਇੱਟ ਭੱਠੇ ਦੇ ਉੱਤੇ ਜਾ ਕੇ ਖੜ੍ਹਿਆ ਅਤੇ ਉਹ ਭੱਠਾ ਇਕਦਮ ਠੰਢਾ ਹੋ ਗਿਆ ਇਹ ਕਾਫੀ ਮਹੱਤਵਪੂਰਨ ਹੈ